ਪੰਜਾਬੀ ਭਾਸ਼ਾ ਦੀ ਵਰਤੋਂ ਲਈ ਜ਼ਰੂਰੀ ਹੈ ਕਿ ਜਿੰਨੇ ਵੀ ਰੇਡੀਓ 'ਤੇ ਪ੍ਰੋਗਰਾਮ ਆਉਂਦੇ ਹਨ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਸਾਰੇ ਪੰਜਾਬੀ ਵਿੱਚ ਆਉਣ ਕਿਉਂਕਿ ਪੰਜਾਬੀ ਇੱਕ ਐਸੀ ਭਾਸ਼ਾ ਹੈ ਬਹੁਤ ਹਰਮਨ ਪਿਆਰੀ ਭਾਸ਼ਾ ਹੈ ਜਿਸਨੂੰ ਕਿ ਹਿੰਦੀ ਬੋਲਣ ਵਾਲੇ ਲੋਕ ਵੀ ਬੜੇ ਆਸਾਨੀ ਨਾਲ ਸਮਝ ਲੈਂਦੇ ਹਨ ਇਸ ਲਈ ਜੇ ਪੰਜਾਬੀ ਦੇ ਜਿੰਨੇ ਵੀ ਪ੍ਰੋਗਰਾਮ ਹਨ ਉਨ੍ਹਾਂ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਪੰਜਾਬੀ ਵਿੱਚ ਹੋਣ ਟੈਲੀਵਿਜ਼ਨ ਦੇ ਉੱਪਰ ਵੀ ਜਿੰਨੇ ਪ੍ਰੋਗਰਾਮ ਆਉਂਦੇ ਹਨ ਉਨ੍ਹਾਂ ਨੂੰ ਵੱਧ ਤੋਂ ਵੱਧ ਪੰਜਾਬੀ ਵਿੱਚ ਦਿਖਾਇਆ ਜਾਵੇ ਤਾਂ ਕਿ ਆਪਣਾ ਜੋ ਆਪਣਾ ਨਵਾਂ ਵਿਰਸਾ ਹੈ ਨਵੀਂ ਪੀੜ੍ਹੀ ਜੋ ਅੱਗੇ ਆਪਣੇ ਆਉਣ ਵਾਲੇ ਨੌਜਵਾਨ ਪੀੜ੍ਹੀ ਹੈ ਉਨ੍ਹਾਂ ਨੂੰ ਪੰਜਾਬੀ ਨਾਲ ਜੋੜਿਆ ਜਾ ਸਕੇ ਸਾਡੀ ਪੰਜਾਬੀ ਇੱਕ ਅਜਿਹੀ ਬੋਲੀ ਹੈ ਜਿਹੜੀ ਜਿਸ ਨੇ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਧੂੰਮਾਂ ਪਾ ਰੱਖੀਆਂ ਹਨ ਪੰਜਾਬੀ ਬੋਲੀ ਇੰਨੀ ਹਰਮਨ ਪਿਆਰੀ ਹੈ ਕਿ ਜਿੱਥੇ ਵੀ ਪੰਜਾਬੀ ਜਾਂਦੇ ਹਨ ਜੋ ਪੰਜਾਬੀ ਬੋਲਦੇ ਹਨ ਉਹ ਹਰ ਇੱਕ ਨੂੰ ਪਿਆਰੇ ਲੱਗਦੇ ਹਨ ਪੰਜਾਬੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀਆਂ ਧੂੰਮਾਂ ਪਾ ਰੱਖੀਆਂ ਹਨ ਇਸ ਲਈ ਇਹ ਜ਼ਰੂਰੀ ਹੈ ਕਿ ਪੰਜਾਬੀ ਭਾਸ਼ਾ ਨੂੰ ਰੇਡੀਓ ਟੈਲੀਵਿਜ਼ਨ ਪ੍ਰਿੰਟ ਵਿੱਚ ਜੋ ਸਾਡੇ ਅਖ਼ਬਾਰ ਛਪਦੇ ਹਨ ਇਹਨਾਂ ਵਿੱਚ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਵਿੱਚ ਛਪਣੇ ਚਾਹੀਦੇ ਹਨ ਤਾਂ ਕਿ ਪੰਜਾਬੀ ਬੋਲੀ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਪੜ ਪੰਜਾਬੀ ਭਾਸ਼ਾ ਸਾਡੀ ਮਾਤਰ ਭਾਸ਼ਾ ਹੋਣ ਦੇ ਨਾਂ 'ਤੇ ਇਹਨਾਂ ਦੀ ਵਰਤੋਂ ਅਸੀਂ ਜਿਵੇਂ ਹੀ ਇਹਨਾਂ ਮੀਡੀਆ ਦੇ ਵਿੱਚ ਵੱਧ ਤੋਂ ਵੱਧ ਕਰਾਂਗੇ ਤਾਂ ਇਹ ਇਸਦਾ ਵਿਕਾਸ ਉੰਨਾ ਹੀ ਜ਼ਿਆਦਾ ਹੋਵੇਗਾ ਪੰਜਾਬੀ ਨੂੰ ਅੱਗੇ ਵਧਾਉਣ ਲਈ ਜੋ ਵੀ ਅਸੀਂ ਆਪਣੇ ਦੁਕਾਨਾਂ ਅੱਗੇ ਅਖ਼ਬਾਰਾਂ ਵਿੱਚ ਜੋ ਵੀ ਆਪਾਂ ਫਲੈਕਸ ਬਣਾਉਂਦੇ ਹਾਂ ਉਹ ਸਾਨੂੁੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਸਾਰੇ ਪੰਜਾਬੀ ਵਿੱਚ ਹੋਣ ਕਿਉਂਕਿ ਜੋ ਘੱਟ ਪੜ੍ਹੇ ਲੋ ਲੋਕ ਹਨ ਉਹ ਵੀ ਪੰਜਾਬੀ ਨੂੰ ਬਹੁਤ ਜਲਦੀ ਸਮਝ ਲੈਂਦੇ ਹਨ ਅਤੇ ਜਿਸਨੂੰ ਬ ਬਾਹਰਲੀ ਸਟੇਟ ਦੇ ਲੋਕ ਹਨ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਜਦੋਂ ਹੀ ਉਹ ਪੰਜਾਬੀ ਨਾਲ ਜੁੜ ਜਾਂਦੇ ਆ ਨਾ ਜਿਵੇਂ ਹੀ ਉਹਨਾਂ ਦਾ ਵਾਹ ਪੰਜਾਬੀ ਨਾਲ ਪ ਪੈ ਜਾਂਦਾ ਹੈ ਪੰਜਾਬੀ 'ਚ ਇੰਨੀ ਸ਼ਕਤੀ ਹੈ ਕਿ ਉਹ ਉਸਨੂੰ ਆਪਣੇ ਵੱਲ ਖਿੱਚ ਲੈਂਦੀ ਹੈ ਉਹ ਉਸ ਨ ਉਸਨੂੰ ਪਹਿਚਾਨਣ ਲੱਗ ਜਾਂਦੇ ਹਨ ਪੜ੍ਹਨ ਲੱਗ ਜਾਂਦੇ ਹਨ ਜਾਣਨ ਲੱਗ ਜਾਣ ਇਸ ਲਈ ਪੰਜਾਬੀ ਦੇ ਰੇਡੀਓ ਟੈਲੀਵਿਜ਼ਨ ਪ੍ਰਿੰਟ ਵਿੱਚ ਜੋ ਵੀ ਇਸ਼ਤਿਹਾਰ ਹਨ ਸਾਰੇ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ